ਸਾਡੇ ਜ਼ਿਆਦਾਤਰ ਵੱਖ ਵੱਖ ਪਕਵਾਨ ਬਣਾਏ ਦੇ ਹਨ ਜਿਨ੍ਹਾਂ ਦੇ ਵਿੱਚੋਂ ਕਿ ਪਕੌੜੇ ਜਲੇਬੀਆਂ ਲੱਡੂ ਬਰਫੀ ਆਦਿ ਹਨ ਅਤੇ ਇਹਨਾਂ ਵਿੱਚੋਂ ਜਿਵੇਂ ਕਿ ਪਕੌੜੇ ਪਕੌੜਿਆਂ ਦੇ ਵਿੱਚ ਵੱਖ ਵੱਖ ਮਸਾਲੇ ਅਤੇ ਕੁਝ ਕੁ ਸਬਜ਼ੀਆਂ ਜਿਵੇਂ ਕਿ ਪਾਲਕ ਗੋਭੀ ਆਲੂ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਅਤੇ ਮਿੱਠੇ ਦੇ ਵਿੱਚ ਪਕਵਾਨਾਂ ਦੇ ਵਿੱਚ ਲੱਡੂ ਬਰਫੀ ਲੱਡੂ ਬਰਫੀ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕਿ ਅਧਿਕਤਰ ਤੌਰ 'ਤੇ ਖੰਡ ਅਤੇ ਕੁਝ ਕੁ ਕੁਝ ਕੁ ਹਿੱਸੇ ਦੇ ਵਿੱਚ ਨਾਰੀਅਲ ਨਾਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ